ਸਾਡੇ ਇਲਾਕੇ ਵਿੱਚ ਵਹਿਮਾਂ ਭਰਮਾਂ ਬਾਰੇ ਇੱਕ ਗੱਲ ਬਹੁਤ ਹੀ ਪ੍ਰਚਲਿਤ ਆ ਲੋਕ ਬੜਾ ਦ੍ਰਿੜਤਾ ਨਾਲ ਇਹਦੇ 'ਤੇ ਵਿਸ਼ਵਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਵੱਡੇ ਵਡੇਰੇ ਜਾਂ ਕੋਈ ਸਾਡਾ ਬਜ਼ੁਰਗ ਹੂ ਉਹਨਾਂ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਪਿੱਤਰ ਪੂਜਣੇ ਜਾਂ ਉਹਨਾਂ ਦੇ ਸਰਾਧ ਕਰਨੇ ਕਿ ਇਹ ਖਾਣਾ ਜੇ ਅਸੀਂ ਪੰਜ ਸਿੰਘਾਂ ਨੂੰ ਖਵਾਵਾਂਗੇ ਜਾਂ ਪੰਜ ਗਰੀਬਾਂ ਨੂੰ ਖਵਾਵਾਂਗੇ ਤਾਂ ਉਹਨਾਂ ਤੱਕ ਪਹੁੰਚ ਹੋ ਜਾਂਦੀ ਹੈ ਇਹ ਸਭ ਤੋਂ ਵੱਡਾ ਵਹਿਮ ਆ ਸਾਡੇ ਇਲਾਕੇ ਵਿੱਚ ਕਿ ਕੋਈ ਵੀ ਚੀਜ਼ ਆ ਮਰਨ ਤੋਂ ਬਾਅਦ ਜੋ ਉਸ ਇਨਸਾਨ ਤੱਕ ਪਹੁੰਚਾਈ ਜਾਂਦੀ ਆ ਕਿ ਕੋਈ ਵੀ ਚੀਜ਼ ਅਸੀਂ ਜਿਸ ਤਰ੍ਹਾਂ ਖਾਣਾ ਬਣਾਉਂਦੇ ਹਾਂ ਅਤੇ ਖਾਣਾ ਬਣਾ ਕੇ ਉਹਦਾ ਰਾਕ ਛੱਡਣਾ ਕਿ ਨਹੀਂ ਇਹ ਸਾਡੇ ਵੱਡੇ ਵਡੇਰੇ ਦਾ ਵਾ ਅਤੇ ਇਹ ਉਹਨੂੰ ਪਹੁੰਚਾਉਣਾ ਕਰਨਾ ਵਾ ਇਹ ਬਹੁਤ ਵੱਡਾ ਵਿਸ਼ਵਾਸ ਆ ਵਹਿਮ ਭਰਮ ਆ ਲੋਕਾਂ ਨੂੰ ਬੜਾ ਤਕੜਾ ਵਿਸ਼ਵਾਸ ਕਰਦੇ ਇਸ ਵਹਿਮ ਭਰਮ 'ਤੇ ਅਤੇ ਦੂਜੀ ਗੱਲ ਹੈ ਛਿੱਕ ਮਾਰਨਾ ਛਿੱਕ ਮਾਰਨ ਨੂੰ ਸਾਡੇ ਇਲਾਕੇ ਵਿੱਚ ਸਭ ਤੋਂ ਅਪਸ਼ਗਨ ਮੰਨਿਆ ਜਾਂਦਾ ਹੈ ਠੀਕ ਆ ਜੀ ਕੋਈ ਵੀ ਸ਼ਗਨਾਂ ਵਾਲਾ ਕੰਮ ਹੋਵੇ ਜਾਂ ਕਿਤੇ ਜਾਣਾ ਹੋਵੇ ਤਾਂ ਛਿੱਕ ਮਾਰਨ ਨੂੰ ਅਪਸ਼ਗਨ ਮੰਨਿਆ ਜਾਂਦਾ ਹੈ